ਹੈਲੋ ਵਧੀਆ ਤੁਸੀਂ ਦੱਸੋ ਤੁਸੀਂ ਕਿੱਦੇਂ ਹੋ ਹਾਂਜੀ ਮੈਂ ਸੋਚਦੀ ਪਈ ਸੀਗੀ ਹਾਂਜੀ ਮੈਂ ਦੇਖੇ ਸੀਗੇ ਇੱਕ ਦੋ ਕੋਲੇਜ ਮੈਂ ਦੇਖਿਆ ਸੀਗਾ ਮੈਂ ਇੱਕ ਕੋਲੇਜ ਹੈ ਉਹ ਗੁਰਦਾਸਪੁਰ ਵਿੱਚ ਐਸ ਡੀ ਕੋਲੇਜ ਦੇਖਿਆ ਸੀਗਾ ਉਹ ਕਾਫੀ ਜ਼ਿਆਦਾ ਵਧੀਆ ਵਾ ਫੋਰ ਵੂਮੈਨਸ ਦੇ ਲਈ ਆ ਕੋਲੇਜ ਡਿਸਿਪਲੀਨ ਵੀ ਕਾਫੀ ਵਧੀਆ ਹੈ ਐਂਡ ਉੱਥੇ ਸਟੱਡੀ ਵੀ ਕਾਫੀ ਵਧੀਆ ਵਾ ਹਾਂਜੀ ਓਨਲੀ ਫੋਰ ਗਰਲਜ਼ ਲਈ ਆ ਹਾਂਜੀ ਉਹ ਤਾਂ ਹੈਗਾ ਹਾਂਜੀ ਹਾਂਜੀ ਉਹ ਮੈਂ ਵੀ ਸੁਣਿਆ ਸੀ ਮੇਰੇ ਉੱਥੇ ਫਰੈਂਡਸ ਵੀ ਪੜ੍ਹਦੇ ਉਨ੍ਹਾਂ ਨੇ ਵੀ ਮੈਨੂੰ ਦੱਸਿਆ ਸੀ ਕਿ ਉੱਥੇ ਹਰ ਇੱਕ ਚੀਜ਼ ਦਾ ਡਿਸਿਪਲੇਨ ਬਹੁਤ ਆ ਹਰ ਇੱਕ ਚੀਜ਼ ਬਹੁਤ ਹੀ ਉਹ ਕੁਛ ਵੀ ਹੋ ਜਾਏ ਮਤਲਬ ਬਹੁਤ ਓ ਕਰਦੇ ਆ ਉੱਥੇ ਹਾਂਜੀ ਉਹ ਡਿਸਿਪਲਿਨ ਤਾਂ ਜ਼ਰੂਰੀ ਹੈ ਨਾ ਹਾਂਜੀ ਠੀਕ ਆ ਮੈਂ ਇਹ ਮੈਂ ਇੱਕ ਕੋਲੇਜ ਹੋਰ ਦੇਖਿਆ ਸੀ ਉਹ ਬੇਅੰਤ ਕੋਲੇਜ ਦੇਖਿਆ ਸੀ ਹਾਂਜੀ ਉੱਥੇ ਕਾਫੀ ਜ਼ਿਆਦਾ ਕਹਿ ਰਹੇ ਕਿ ਸਟੱਡੀ ਵੀ ਵਧੀਆ ਵਾ ਐਂਡ ਟੀਚਰਸ ਵੀ ਉੱਥੇ ਵਧੀਆ ਡਸਿਪਲੀਨ ਵੀ ਹੈਗਾ ਸਭ ਕੁਛ ਉੱਥੇ ਵਧੀਆ ਵਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਾਲੇ ਉਹ ਕਹਿ ਰਹੇ ਸੀਗੇ ਕਿ ਜਿੱਦਾਂ ਬਾਕੀ ਇੰਜੀਨੀਅਰਿੰਗ ਕੋਲੇਜ ਆ ਅਗਰ ਤੁਸੀਂ ਉਹ ਕਰਨਾ ਇੰਜੀਨੀਅਰ ਕਰਨਾ ਚਾਹੁੰਦੇ ਹੋ ਸੋ ਬਾਕੀ ਜਿਹੜੇ ਕੋਲੇਜਸ ਆ ਉਨ੍ਹਾਂ ਦੇ ਵਿੱਚ ਫੀਸ ਵੀ ਕਾਫੀ ਜ਼ਿਆਦਾ ਅਤੇ ਇੱਥੇ ਫੀਸ ਦਾ ਵੀ ਥੋੜ੍ਹਾ ਘੱਟ ਹੈਗੀ ਆ ਮੈਨੇਜ ਹੋ ਸਕਦਾ ਵਾ ਹਾਂਜੀ ਆਪਾਂ ਇੱਥੇ ਟਰਾਈ ਕਰ ਲਵਾਂਗੇ ਕੋਈ ਨਹੀਂ ਹਾਂਜੀ ਮੈਂ ਇੰਜੀਨੀਅਰਿੰਗ ਕਰਨੀ ਤੁਸੀਂ ਕੀ ਕਰਨੀ ਹਾਂ ਕੋਈ ਨਹੀਂ ਫਿਰ ਅਸੀਂ ਇਕੱਠੇ ਚੱਲ ਜਾਵਾਂਗੇ ਠੀਕ ਹੈ ਓਕੇ ਓਕੇ ਬਾਏ